ਸਾਨੂੰ ਬਾਗਬਾਨੀ ਸ਼ੁਰੂ ਕਰਨ ਲਈ ਸਾਡੇ ਖਾਲੀ ਸਮੇਂ ਨੇ ਪ੍ਰੇਰਿਤ ਕੀਤਾ ਸਾਡੇ ਕੋਲ ਬੱਚਿਆਂ ਨੂੰ ਸਕੂਲ ਭੇਜ ਕੇ ਅਤੇ ਘਰ ਵਾਲਿਆਂ ਨੂੰ ਡਿਊਟੀ 'ਤੇ ਭੇਜ ਕੇ ਵਿਹਲਾ ਸਮਾਂ ਹੁੰਦਾ ਸੀ ਅਤੇ ਉਹਦੇ ਵਿੱਚ ਸਾਡੇ ਕੋਲ ਜਗ੍ਹਾ ਵੀ ਸੀ ਇਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਉਥੇ ਬਾਗਬਾਨੀ ਲਗਾਈ ਜਾਵੇ ਅਤੇ ਆਪਣੇ ਘਰ ਦਾ ਵੀ ਮਾਹੌਲ ਵਧੀਆ ਕੀਤਾ ਜਾਵੇ ਇਸ ਕਰਕੇ ਅਸੀਂ ਬਾਗਬਾਨੀ ਦੀ ਸ਼ੁਰੂਆਤ ਕੀਤੀ